ਕਿਫਾਇਤੀ ਆਵਾਜਾਈ ਦੀ ਘਾਟ ਨੇ ਨੇੜਲੇ ਸ਼ਹਿਰਾਂ ਜਾਂ ਕਸਬਿਆਂ ਵਿੱਚ ਸਿਹਤ ਸੰਭਾਲ ਸਿੱਖਿਆ ਜਾਂ ਨੌਕਰੀ ਦੇ ਮੌਕਿਆਂ ਦੀ ਭਾਲ ਕਰਨ ਵਿੱਚ ਮੈਨੂੰ ਮੇਰੀ ਯੋਗਤਾ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਪਹਿਲਾਂ ਮੈਂ ਘਰ ਹੀ ਵਿਹਲਾ ਰਹਿੰਦਾ ਸੀ ਮੈਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਮੈਂ ਘਰ ਬਿਲਕੁਲ ਹੀ ਵਿਹਲਾ ਰਹਿੰਦਾ ਸੀ ਹੁਣ ਮੈਂ ਸਿਹਤ ਸੰਭਾਲ ਸੈਂਟਰ ਵਿੱਚ ਨੌਕਰੀ ਲੱਗ ਗਿਆ ਹਾਂ ਪਹਿਲਾਂ ਸਾਡੇ ਨੇੜਲੇ ਸ਼ਹਿਰਾਂ ਵਿੱਚ ਕੋਈ ਵੀ ਅਜਿਹਾ ਸਥਾਨ ਨਹੀਂ ਸੀ ਜਿੱਥੇ ਮੈਂ ਨੌਕਰੀ ਕਰ ਸਕਾਂ ਅਤੇ ਮੈਨੂੰ ਦੂਰ ਦੂਰ ਆਪਣੀ ਨੌਕਰੀ ਬਾਰੇ ਜਾਣਾ ਪੈਂਦਾ ਸੀ ਹੁਣ ਜਦੋਂ ਦੀ ਇਹ ਨਵੀਂ ਸਰਕਾਰ ਆਈ ਹੈ ਇੱਥੇ ਸਿਹਤ ਸੰਭਾਲ ਸੈਂਟਰ ਸਿੱਖਿਆ ਵਾਲੇ ਸੈਂਟਰ ਅਤੇ ਹੋਰ ਨੌਕਰੀ ਨੌਕਰੀਆਂ ਬਹੁਤ ਵਧੀਆ ਖੁੱਲ੍ਹੀਆਂ ਹਨ ਇਸ ਨੇ ਮੇਰੇ ਅੰਦਰ ਬਹੁਤ ਜਾਗਰੂਕਤਾ ਜਗਾਈ ਹੈ ਅਤੇ ਹੁਣ ਮੈਂ ਸਿਹਤ ਸੈਂਟਰ ਦੇ ਵਿੱਚ ਨੌਕਰੀ ਕਰਦਾ ਹਾਂ ਮੈਨੂੰ ਪਹਿਲਾਂ ਨੌਕਰੀ ਲਈ ਬਹੁਤ ਦੂਰ ਦੂਰ ਫਾਰਮ ਭਰਨੇ ਪੈਂਦੇ ਸੀ ਅਤੇ ਹੁਣ ਮੈਨੂੰ ਨੇੜੇ ਹੀ ਨੌਕਰੀ ਮਿਲ ਗਈ ਹੈ ਧੰਨਵਾਦ